ਸਾਡਾ ਪਿੰਡ ਬਹੁਤ ਹੀ ਛੋਟਾ ਜਿਹਾ ਪਿੰਡ ਹੈ ਇਹ ਪਹਿਲਾਂ ਬਹੁਤ ਹੀ ਪਿਛੜਿਆ ਹੋਇਆ ਸੀ ਖੁੱਲ੍ਹੇ ਵਿੱਚ ਬਾਹਰ ਜਾਣਾ ਆਮ ਗੱਲ ਸੀ ਪਹਿਲਾਂ ਸਾਰੇ ਖੁੱਲ੍ਹੇ ਵਿੱਚ ਹੀ ਜਾਂਦੇ ਸਨ ਜਿਸ ਦੇ ਬਹੁਤ ਸਾਰੇ ਨੁਕਸਾਨ ਸਨ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਸਨ ਖੁੱਲ੍ਹੇ ਵਿੱਚ ਮਲ ਤਿਆਗ ਕਰਨਾ ਆਮ ਬਿਮਾਰੀਆਂ ਨੂੰ ਸੱਦਾ ਦੇਣਾ ਸੀ ਇਸ ਨਾਲ ਜੀਵਾਣੂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਚਲੇ ਜਾਂਦੇ ਸਨ ਇਸ ਨਾਲ ਬਹੁਤ ਸਾਰੀ ਗੰਦਗੀ ਵੀ ਫੈਲਦੀ ਹੈ ਇਸ ਨਾਲ ਮੱਖੀਆਂ ਮੱਛਰ ਆਉਂਦੇ ਹਨ ਅਤੇ ਬਹੁਤ ਸਾਰੀ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ ਜਦੋਂ ਕਿਸੇ ਦੂਸਰੇ ਵਿਅਕਤੀ ਦੇ ਉੱਪਰ ਬੈਠਦੇ ਹਨ ਤਾਂ ਬਿਮਾਰੀਆਂ ਨੂੰ ਵਧਾਉਂਦੇ ਹਨ ਇਸ ਨਾਲ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਹਨ ਇਸ ਲਈ ਖੁੱਲ੍ਹੇ ਵਿੱਚ ਪਖਾਨੇ ਨਹੀਂ ਹੋਣੇ ਚਾਹੀਦੇ ਹੁਣ ਸਾਡੇ ਪਿੰਡ ਨੇ ਵੀ ਬਹੁਤ ਵਿਕਾਸ ਕਰ ਲਿਆ ਹੈ ਅਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਲਿਆ ਹੈ ਇਸ ਕਰਕੇ ਖੁੱਲੇ ਪਕ ਵਿੱਚ ਪਖਾਨੇ ਨਹੀਂ ਹੋਣੇ ਚਾਹੀਦੇ ਕਿਉਂਕਿ ਜੇ ਖੁੱਲ੍ਹੇ ਵਿੱਚ ਪਖਾਨੇ ਹਨ ਹੁੰਦੇ ਹਨ ਤਾਂ ਬਹੁਤ ਹੀ ਸਾਰੀ ਬਿਮਾਰੀਆਂ ਨੂੰ ਆਪ ਹੀ ਸੱਦਾ ਦੇਣਾ ਸੀ ਇਸ ਕਰਕੇ ਸਾਡੇ ਪਿੰਡਾਂ ਨੇ ਬਹੁਤ ਸਾਰੇ ਪਿੰਡਾਂ ਵਿੱਚ ਬਹੁਤ ਹੀ ਵਿਕਾਸ ਕਰ ਲਿਆ ਹੈ ਖੁੱਲ੍ਹੇ ਵਿੱਚ ਪਖਾਨੇ ਬਣਾਉਣੇ ਬੰਦ ਕਰ ਦਿੱਤੇ ਹਨ ਅਤੇ ਜਿਸ ਨਾਲ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ ਆਮ ਗੱਲ ਸੀ ਪਹਿਲਾਂ ਖੁੱਲ੍ਹੇ ਵਿੱਚ ਪਖਾਨੇ ਸਨ ਪਰੰਤੂ ਇਸ ਸਾਲ ਭਾਵ ਇਸ ਦੁਨੀਆ ਹੁਣ ਕਦੇ ਖੁੱਲ੍ਹੇ ਪਖਾਨੇ ਨਹੀਂ ਬਣਾਏ ਜਾ ਰਹੇ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਕੀਟਾਣੂ ਹੈਜਾ ਆਦਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਆਪ ਹੀ ਸੱਦਾ ਦੇਣਾ ਸੀ